ਹਾਂਜੀ ਕਿਵੇਂ ਹੋ ਹੋਰ ਦੱਸੋ ਠੀਕ ਠਾਕ ਜੀ ਬਸ ਜੀ ਬੈਠੇ ਸੀਗੇ ਫ੍ਰੀ

ਹਾਂਜੀ ਮੈਂ ਤਾਂ ਇਸ ਤਾਂ ਇਸ ਲਈ ਫੋਨ ਕੀਤਾ ਸੀਗਾ ਜੀ ਕਿ ਕੱਲ੍ਹ ਤੁਹਾਨੂੰ ਪਤਾ ਕੀ ਆ ਕੀ ਸੋਚਿਆ ਕੱਲ੍ਹ ਬਾਰੇ ਕੱਲ੍ਹ ਐਤਵਾਰ ਆ ਤੁਸੀਂ ਕਿਹਾ ਕਹਿ ਰਹੇ ਸੀਗੇ ਨਾ ਕਿਤੇ ਆਪਾਂ ਜਾਣਾ ਹੈ ਕਿੱਥੇ ਜਾਣਾ ਅੱਛਾ ਜੀ ਕੇਕ ਕਿੱਥੇ ਲੈ ਕੇ ਆਉਂਗੇ ਅੱਛਿਆ ਜੀ ਅਗਲੇ ਹਫਤੇ ਪਤਾ ਤੁਹਾਨੂੰ ਕੀ ਆ ਅਗਲੇ ਹਫਤੇ ਆਪਣੀ ਜਸਮੀਤ ਦਾ ਜਨਮ ਦਿਨ ਆ ਤਾਂ ਆਪਾਂ ਕਿੱਥੇ ਮਨਾਉਣਾ ਜੀ ਇਸ ਬਾਰੇ ਘਰ ਡੈਡੀ ਹੋਣਾ ਨਾਲ ਸਲਾਹ ਕਰਨੀ ਆ

ਠੀਕ ਹੋਰ ਜੀ ਹੋਰ ਵੀ ਕੀ ਕਰਨਾ ਸੋਚਿਆ ਅੱਛਾ ਜੀ ਚਲੋ ਠੀਕ ਹੈ ਜੀ ਫਿਰ ਹਾਂਜੀ ਠੀਕ